ਸਾਡੇ ਪੰਜਾਬ ਵਿੱਚ ਬਹੁਤ ਸਾਰੇ ਮਹੱਤਵਪੂਰਨ ਸੱਭਿਆਚਾਰਕ ਪ੍ਰੰਪਰਾਵਾਂ 'ਤੇ ਰੀਤੀ ਰਿਵਾਜ ਹੁੰਦੇ ਹਨ ਜਿਵੇਂ ਕਿ ਜਿਹੜੇ ਕਿ ਸਾਡੇ ਤਿਉਹਾਰਾਂ ਨਾਲ ਅਤੇ ਸਾਡੇ ਵਿਆਹ ਸ਼ਾਦੀਆਂ ਦੇ ਮੌਕਿਆਂ ਨਾਲ ਜੁੜੇ ਹੁੰਦੇ ਹਨ ਉਨ੍ਹਾਂ ਪਿੱਛੇ ਵੀ ਬਹੁਤ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਹਨ ਜੋ ਕਿ ਅਸੀਂ ਦੇਖਦੇ ਹਾਂ ਜਿੱਦਾਂ ਹੁਣ ਅਸੀਂ ਦੇਖੀਏ ਹੋਲੀ ਵਾਲੇ ਦਿਨ ਜਾਂ ਲੋਹੜੀ ਵਾਲੇ ਦਿਨ ਅਸੀਂ ਲੋਹੜੀ ਬਾਲਦੇ ਹਾਂ ਜਾਂ ਹੋਲੀ ਬਾਲਦੇ ਹਾਂ ਠੀਕ ਹੈ ਉਹਦੇ ਵਿੱਚ ਵੀ ਇੱਕ ਪਿੱਛੇ ਵੱਡੀ ਗੱਲ ਹੈ ਜਿਵੇਂ ਕਿ ਸ ਉਂ ਮੰਨਿਆ ਜਾਂਦਾ ਹੈ ਕਿ ਸਾਰੀਆਂ ਬੁਰਾਈਆਂ ਜਿਹੜੀਆਂ ਹੈ ਉਹ ਹੋ ਹੋਲੀ ਬਾਲਣ 'ਤੇ ਜਾਂ ਲੋਹੜੀ ਬਾਲਣ 'ਤੇ ਦੂਰ ਹੋ ਜਾਂਦੀਆਂ ਅਤੇ ਪ੍ਰੰਪਰਾਵਾਂ ਦੀ ਗੱਲ ਕੀਤੀ ਜਾਏ ਤਾਂ ਘਰ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਅਤੇ ਬੱਚੇ ਅਤੇ ਮਾਂ ਲਾਗੇ ਜਿਹੜੇ ਹੈ ਉਹ ਤਾਲ਼ਾ ਜਾਂ ਫਿਰ ਕੋਈ ਲੋਹੇ ਦੀ ਚੀਜ਼ ਰੱਖ ਦਿੱਤੀ ਜਾਂਦੀ ਹੈ ਜੋ ਕਿ ਸ਼ੁਰੂ ਤੋਂ ਪ੍ਰੰਪਰਾ ਚੱਲਦੀ ਆਣਡਈ ਹੈ ਕਿ ਉਨ੍ਹਾਂ ਉਹਦੇ ਪਿੱਛੇ ਇਹ ਕਾਰਨ ਹੈ ਕਿ ਉਨ੍ਹਾਂ ਦੇ ਕੋਲ ਕੋਈ ਬੁਰੀ ਚੀਜ਼ ਦਾ ਪਰਛਾਵਾਂ ਨਾ ਪਵੇ ਅਤੇ ਪੰਜਾਬੀ ਫੋਕ ਡਾਂਸ ਦੀ ਜੇ ਗੱਲ ਕੀਤੀ ਜਾਏ ਤਾਂ ਪੰਜਾਬੀ ਭੰਗੜਾ ਅਤੇ ਗਿੱਧਾ ਜਿਹੜੇ ਕਿ ਸਾਡੇ ਪੰਜਾਬ ਦੇ ਮਸ਼ ਮਸ਼ਹੂਰ ਜਿਹੜੇ ਹੈ ਉਹ ਫੋਕ ਡਾਂਸ ਹਨ ਪਿੱਛਲੇ ਸਮੇਂ ਵਿੱਚ ਬਹੁਤ ਜ਼ਿਆਦਾ ਭੰਗੜਾ ਅਤੇ ਗਿੱਧਾ ਕੀਤਾ ਜਾਂਦਾ ਸੀ ਹੁਣ ਵੀ ਜ਼ਿਆਦਾਤਰ ਵਿਆਹ ਸ਼ਾਦੀਆਂ 'ਤੇ ਭੰਗੜਾ ਅਤੇ ਗਿੱਧਾ ਪਾਇਆ ਜਾਂਦਾ ਹੈ ਸਕੂਲਾਂ ਕਾਲਜਾਂ ਵਿੱਚ ਪ੍ਰਤਿਯੋਗਤਾਵਾਂ ਕੀਤੀਆਂ ਜਾਂਦੀਆਂ ਹਨ ਅਤੇ ਵਿਆਹ ਵਾਲੇ ਘਰਾਂ ਵਿੱਚ ਵੀ ਗੀਤ ਗਾਏ ਜਾਂਦੇ ਹਨ ਜੇ ਫੋਕ ਸੋਂਗ ਦੀ ਗੱਲ ਕੀਤੀ ਜਾਏ ਜਿੱਦਾਂ ਕੁੜੀ ਦੇ ਸੋ ਸੁਹਾਗ ਗਾਏ ਜਾਂਦੇ ਹਨ ਅਤੇ ਮੁੰਡੇ ਵਾਲਿਆਂ ਦੇ ਘਰ ਜਿਹੜੇ ਹੈ ਘੋੜੀਆਂ ਗਾਈਆਂ ਜਾਂਦੀਆਂ ਹੈ ਇਸ ਤਰ੍ਹਾਂ ਸਾਡੇ ਪੰਜਾਬ ਵਿੱਚ ਮਹੱਤਵਪੂਰਨ ਪ੍ਰੰਪਰਾਵਾਂ ਅਤੇ ਰੀਤੀ ਰਿਵਾਜ ਜਿਹੜੇ ਹੈ ਉਹ ਅਪਣਾਏ ਜਾਂਦੇ ਹਨ